ਹਾਂਜੀ ਮੈਡਮ ਅੱਜ ਤੁਸੀਂ ਸਕੂਲ ਕਿਉਂ ਨਹੀਂ ਆਏ ਅੱਜ ਕੋਈ ਬਾਹਰੋਂ ਆਏ ਸੀ ਟੀਚਰ ਅਤੇ ਤੁਹਾਨੂੰ ਤੁਹਾਡਾ ਆਉਣਾ ਜ਼ਰੂਰੀ ਸੀ ਉਹ ਪੁੱਛ ਰਹੇ ਸੀ ਮੈਡਮ ਆਏ ਨਹੀਂ ਅਤੇ ਬੱਚੇ ਵੀ ਕਹਿ ਰਹੇ ਸੀ ਮੈਡਮ ਨਹੀਂ ਆਏ ਅੱਜ ਜ਼ਰੂਰੀ ਕੰਮ ਸੀ ਸਕੂਲ 'ਚ ਫਿਰ ਤੁਹਾਡਾ ਆਉਣਾ ਜ਼ਰੂਰੀ ਸੀ ਹਾਂਜੀ ਹਾਂਜੀ ਤੁਸੀਂ ਅੱਜ ਛੁੱਟੀ 'ਤੇ ਸੀ ਲੀਵ ਦਿੱਤੀ ਸੀ ਅੱਜ ਤੁਸੀਂ ਲੀਵ ਦਿੱਤੀ ਸੀ ਤੁਸੀਂ ਵੀ ਨਹੀਂ ਆਉਣਾ ਸਕੂਲ ਅੱਛਾ ਅੱਛਾ ਅੱਜ ਬਹੁਤ ਵੱਡਾ ਪ੍ਰੋਗਰਾਮ ਸੀ ਸਕੂਲ 'ਚ

ਅੱਛਾ ਅੱਛਾ ਫੰਕਸ਼ਨ ਬਾਰੇ ਗੱਲ ਕਰਦੇ ਪਏ ਸੀ ਫੰਕਸ਼ਨ ਕਰਨਾ ਸਕੂਲ 'ਚ ਅਤੇ ਉਹ ਡਿਊਟੀਆਂ ਲਗਾਉਣੀਆਂ ਸੀ ਸਾਰੇ ਟੀਚਰਾਂ ਦੀਆਂ ਤੁਹਾਡੀ ਵੀ ਲਗਾਉਣੀ ਸੀ ਅਤੇ ਤੁਸੀਂ ਆਏ ਨਹੀਂ ਫਿਰ ਇਹ ਲਗਾਉਣੀ ਹਾਲੇ ਤੁਸੀਂ ਦੱਸੋ ਕੱਲ੍ਹ ਆਓਗੇ ਅੱਛਾ ਅੱਛਾ ਫੰਕਸ਼ਨ ਵਾਲੇ ਦਿਨ ਜ਼ਰੂਰ ਪਹੁੰਚਣਾ ਹੈ ਤੁਸੀਂ ਛੁੱਟੀ ਨਹੀਂ ਕਰਨੀ ਹਾਂਜੀ ਤੁਹਾਡੀ ਡਿਊਟੀ ਲਗਾਵਾਂਗੇ ਔਰ ਫਿਰ ਤੁਸੀਂ ਆਉਣਾ ਹੈ ਜ਼ਰੂਰੀ ਹਾਂਜੀ ਪੂਰੀ ਡਿਊਟੀ ਦੇਣੀ ਹੈ ਸੂਬਹ ਤੋਂ ਲੈ ਕੇ ਸ਼ਾਮ ਤੱਕ ਸਾਰੇ ਫੰਕਸ਼ਨ ਵਿੱਚ ਬਿਲਕੁਲ ਵੀ ਛੁੱਟੀ ਨਹੀਂ ਮਾਰਨੀ ਉਸ ਦਿਨ

ਹਾਂਜੀ ਫੰਕਸ਼ਨ 'ਚ ਡਿਊਟੀ ਲਗਾਵਾਂਗੇ ਨਾ ਬੱਚੇ ਕਿੰਨੇ ਆਏ ਹੈ ਕਿੰਨੇ ਬਾਹਰ ਨੇ ਸਾਰਾ ਧਿਆਨ ਕਰਨਾ ਕੋਈ ਵੀ ਬਿਨਾਂ ਪੁੱਛੇ ਬਾਹਰ ਨਾ ਜਾਏ ਸਕੂਲ ਤੋਂ ਕਲਾਸ ਵਿੱਚ ਪਹੁੰਚਗੇ ਪਰਫੋਰਮੈਂਸ ਸਹੀ ਕਰਤੀ ਸਾਰਾ ਤੁਸੀਂ ਧਿਆਨ ਹਾਂਜੀ ਐਨੂਅਲ ਫੰਕਸ਼ਨ ਹੈ ਜੀ ਸਾਲ 'ਚ ਇੱਕ ਵਾਰੀ ਕਰਦੇ ਐ ਜਿਹੜਾ ਸਾਰੇ ਬੱਚੇ ਪਾਰਟੀਸਪੇਟ ਕਰਨਗੇ ਡਾਂਸ ਕਰਨਗੇ ਸਕਿੱਟ ਕਰਨਗੇ ਹਾਂਜੀ ਅਤੇ ਤੁਹਾਡੀ ਡਿਊਟੀ ਲਗਾਉਣੀ ਜ਼ਰੂਰੀ ਪਹੁੰਚਣਾ ਹੈ ਸਕੂਲ 'ਚ